ਇੱਕ ਉਦਯੋਗਪਤੀ ਨੂੰ ਉਦਯੋਗ ਨੂੰ ਵਧਾਉਣ ਦੇ ਲੀਏ ਬਹੁਤ ਸਾਰੇ ਕਾਰਨਾਂ ਉੱਤੇ ਧਿਆਨ ਦੇਣਾ ਪੈਂਦਾ ਹੈ ਜਿਵੇਂ ਕਿ ਨਿਵੇਸ਼ ਕਿੱਥੋਂ ਲਿਆਉਣਾ ਹੈ ਨਵੇਂ ਉਦਯੋਗਾਂ ਦੇ ਵਿੱਚ ਵਿਅਕਤੀ ਬਹੁਤ ਘੱਟ ਹੁੰਦੇ ਹਨ ਜੋ ਕਿ ਨਿਵੇਸ਼ ਕਰਦੇ ਹਨ ਨਿਵੇਸ਼ ਉਦਯੋਗ ਦੇ ਲੀਏ ਬਹੁਤ ਹੀ ਜ਼ਰੂਰੀ ਹੁੰਦਾ ਹੈ ਪਰ ਨਵੇਂ ਉਦਯੋਗਾਂ ਦੇ ਵਿੱਚ ਲੋਕ ਨਿਵੇਸ਼ ਨਹੀਂ ਕਰਦੇ ਇਹ ਬਹੁਤ ਵੱਡਾ ਕਾਰਨ ਹੈ ਜੋ ਕਿ ਉਦਯੋਗਪਤੀ ਨੂੰ ਦੇਖਣਾ ਪੈਂਦਾ ਹੈ ਇਸ ਤੋਂ ਇਲਾਵਾ ਨਕਦੀ ਦਾ ਪ੍ਰਬੰਧ ਵੀ ਉਦਯੋਗਪਤੀ ਨੂੰ ਕਰਨਾ ਪੈਂਦਾ ਹੈ ਜਿੱਦਾਂ ਕਿ ਨਵੇਂ ਉਦਯੋਗਾਂ ਦੇ ਵਿੱਚ ਆਪਣਾ ਸਮਾਨ ਬਹੁਤ ਥਾਵਾਂ 'ਤੇ ਉਧਾਰ 'ਤੇ ਵੀ ਦੇਣਾ ਪੈਂਦਾ ਹੈ ਪਰ ਉਦਯੋਗਪਤੀ ਨੂੰ ਨਕਦੀ ਦਾ ਪ੍ਰਬੰਧ ਸਹੀ ਤਰੀਕੇ ਨਾਲ ਕਰਨਾ ਪੈਂਦਾ ਹੈ ਕਿ ਕੱਲ੍ਹ ਨੂੰ ਕੱਚਾ ਮਾਲ ਲਿਆਉਣ ਦੇ ਲੀਏ ਨਕਦੀ ਦਾ ਘਾਟ ਨਾ ਹੋ ਜਾਏ ਇਸ ਤੋਂ ਇਲਾਵਾ ਉਦਯੋਗ ਜਗਤ ਨੂੰ ਬਹੁਤ ਵੱਡੇ ਵੱਡੇ ਕਰਜ਼ੇ ਵੀ ਲੈਣੇ ਪੈਂਦੇ ਹਨ ਇਸ ਦੇ ਨਾਲ ਹੀ ਉਸਨੂੰ ਕਰਜ਼ਿਆਂ ਉੱਤੇ ਲੱਗਣ ਵਾਲੇ ਵਿਆਜ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਇਸ ਤੋਂ ਇਲਾਵਾ ਟੈਕਸ ਅਤੇ ਆਰਥਿਕ ਨੀਤੀਆਂ 'ਤੇ ਵੀ ਧਿਆਨ ਦੇਣਾ ਪੈਂਦਾ ਹੈ ਪ੍ਰਸ਼ਾਸਨ ਜਟਿਲਤਾਵਾਂ ਕਾਰਨ ਟੈਕਸ ਸਿਸਟਮ ਦਾ ਸਹੀ ਫਾਇਦਾ ਨਹੀਂ ਮਿਲਦਾ ਜਿਸ ਨਾਲ ਉਦਯੋਗਾਂ ਤੋਂ ਲਾਭ ਵਿੱਚ ਘਾਟ ਹੁੰਦੀ ਹੈ